ਹੈਲੋ ਹੈਲੋ ਕਿਵੇਂ ਹੈ ਪੰਮੋ ਵਧੀਆ ਵਧੀਆ ਕਿਵੇਂ ਹਾਂ ਠੀਕ ਹਾਂ ਵਧੀਆ ਵਧੀਆ ਕੀ ਕਰਦੀ ਸੀ ਫ੍ਰੀ ਟਾਈਮ ਹੈਗਾ ਹਾਂਜੀ ਵਧੀਆ ਫ੍ਰੀ ਵਧੀਆ ਵਧੀਆ ਯਾਰ ਇੱਕ ਤੇਰੇ ਤੋਂ ਰਾਏ ਜਿਹੀ ਲੈਣੀ ਸੀ ਜਾਂ ਫਿਰ ਕੁਛ ਐਂ ਹੀ ਕਹਿ ਦੇ ਵੀ ਮੋਟੀਵੇਟ ਕਰ ਮੈਨੂੰ ਮੈਂ ਆਪਣੀ ਲਾਈਫ 'ਚ ਬਹੁਤ ਡੀਮੋਟੀਵੇਟ ਹੋਈ ਹੋਈ ਹਾਂ ਅਤੇ ਹਾਂ ਮੈਨੂੰ ਮੋਟੀਵੇਟ ਕਰ ਮੈਨੂੰ ਨਹੀਂ ਪਤਾ ਮੇਰਾ ਜੀਅ ਨਹੀਂ ਲੱਗ ਰਿਹਾ ਅੱਜ ਤਾਂ

ਅੱਛਾ ਅੱਛਾ ਅੱਛਾ ਅੱਛਾ

ਅੱਛਾ ਅੱਛਾ ਠੀਕ ਆ ਹੂੰ ਅੱਛਾ ਹੂੰ ਹੂੰ ਹੂੰ

ਹਾਂ ਹਾਂ ਹਾਂ

ਠੀਕ ਹੈ

ਠੀਕ ਹੈ ਠੀਕ ਹੈ ਠੀਕ ਹੈ ਮੈਂ ਫਿਰ ਕੱਲ੍ਹ ਆਊਂਗੀ ਤੇਰੇ ਕੋਲ ਅਤੇ ਮੈਂ ਕਿਤਾਬ ਲੈ ਕੇ ਜਾਊਂਗੀ ਠੀਕ ਹੈ ਮੈਂ ਇਹ ਵੀ ਸੁਣਿਆ ਸੀ ਵੀ ਉਹ ਦੀਵਾਨ ਵੀ ਲਗਾਉਂਦੇ ਹੈ ਕਿਸੇ ਤੋਂ ਸੁਣਿਆ ਸੀ ਮੈਂ ਵੀ ਓੱਥੇ ਵੀ ਵਾਧੂ ਗਿਆਨ ਦਿੰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਓਕੇ ਚੱਲ ਠੀਕ ਹੈ ਬਾਏ